ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਹਰ ਪ੍ਰਕਾਰ ਦੀ ਖੇਡ ਖੇਡੀ ਜਾਂਦੀ ਹੈ ਇੱਥੇ ਹਰ ਇੱਕ ਨੇ ਨੌਜਵਾਨ ਜੋ ਕਿ ਬਹੁਤ ਹੀ ਤਗੜਾ ਹੈ ਉਹ ਹਰ ਇੱਕ ਖੇਡ ਖੇਡਣ ਦਾ ਸ਼ੌਂਕੀ ਹੁੰਦਾ ਹੈ ਜਿਵੇਂ ਕਿ ਗੱਲ ਕਰੀਏ ਕਬੱਡੀ ਦੀ ਕ੍ਰਿਕਟ ਦੀ ਵੋਲੀਬਾਲ ਦੀ ਇਹ ਅਜਿਹੀਆਂ ਖੇਡਾਂ ਨੇ ਜੋ ਕਿ ਪੰਜਾਬ ਦੇ ਵਿੱਚ ਬੜੇ ਆਨੰਦ ਅਤੇ ਉਤਸ਼ਾਹ ਨਾਲ ਖੇਡੀਆਂ ਜਾਂਦੀਆਂ ਹਨ ਜੋ ਬੱਚਾ ਫਿਜੀਕਲ ਐਜੂਕੇਸ਼ਨ ਦੇ ਨਾਲ ਜੁੜਿਆ ਹੈ ਉਸ ਨੂੰ ਖੇਡਾਂ ਤਾਂ ਬਹੁਤ ਹੀ ਪਸੰਦ ਹੁੰਦੀਆਂ ਨੇ ਜਿਵੇਂ ਕਿ ਉਹ ਤਾਂ ਵਾਲੀਬਾਲ ਦਾ ਚੈਂਪੀਅਨ ਵੀ ਰਹਿ ਚੁੱਕਿਆ ਹੁੰਦਾ ਹੈ ਜਿਵੇਂ ਕਿ ਹਰ ਇੱਕ ਖੇਡਾਂ ਖੇਡ ਦੌੜ ਵਿੱਚ ਉਹ ਬਹੁਤ ਹੀ ਅੱਗੇ ਰਹਿੰਦਾ ਇੱਥੇ ਕਈ ਤਰ੍ਹਾਂ ਦੇ ਲੋਕ ਹੁੰਦੇ ਨੇ ਜੋ ਕਿ ਬਹੁਤ ਬੱਚਿਆਂ ਨੂੰ ਅੱਗੇ ਵੱਧਦਾ ਵੇਖਣਾ ਚਾਹੁੰਦੇ ਹਨ ਉਹਨਾਂ ਵਿੱਚੋਂ ਕਈ ਸਾਡੇ ਪਿੰਡ ਦੇ ਇੱਕ ਮੋਹਦਵਾਰ ਬੰਦੇ ਹਨ ਜਿਹਨਾਂ ਨੇ ਇੱਕ ਸੰਗਠਨ ਤਿਆਰ ਟੀਮ ਤਿਆਰ ਕਰਕੇ ਰੱਖੀ ਹੋਈ ਏ ਪਿੰਡ ਦੇ ਬੱਚਿਆਂ ਵਾਸਤੇ ਉਹ ਕ ਟੂਰਨਾਮੈਂਟ ਔਰਗਨਾਈਜ਼ ਕਰਦੇ ਹਨ ਬੱਚਿਆਂ ਵਾਸਤੇ ਜਿਵੇਂ ਕਿ ਕਬੱਡੀ ਕੱਪ ਕਰ ਦਿੰਦੇ ਹਨ ਕ੍ਰਿਕਟ ਦਾ ਟੂਰਨਾਮੈਂਟ ਔਰਗਨਾਈਜ਼ ਕਰ ਦਿੰਦੇ ਹਨ ਵੋਲੀਬਾਲ ਟੂਰਨਾਮੈਂਟ ਔਰਗਨਾਈਜ਼ ਕਰ ਦਿੰਦੇ ਇਹ ਸਭ ਕਰਨ ਦੇ ਵਿੱਚ ਉਹ ਇਹਨਾਂ ਨੂੰ ਉਤਸ਼ਾਹ ਬਣਾ ਇਹਨਾਂ ਦਾ ਉਤਸ਼ਾਹ ਵਧਾਉਂਦੇ ਹਨ ਨਾਲੇ ਇਹਨਾਂ ਨੂੰ ਜੇਤੂ ਐਲਾਨ ਕਰਦੇ ਹਨ ਜਿਹੜਾ ਬੱਚਾ ਬਹੁਤ ਹੀ ਵਧੀਆ ਖੇਡਦਾ ਹੈ ਉਸ ਨੂੰ ਤਾਂ ਕਈ ਵਕਤ ਕਈ ਵਾਰ ਉਸਨੂੰ ਪੈਸੇ ਨਾਲ ਨਿਵਾਜਿਆ ਜਾਂਦਾ ਹੈ ਜਿਵੇਂ ਕਈ ਵਕਤ ਗਿਆਰ੍ਹਾਂ ਹਜ਼ਾਰ ਦਾ ਇਨਾਮ ਮਿਲਦਾ ਹੈ ਕਈ ਵਾਰ ਇੱਕੀ ਹਜ਼ਾਰ ਦਾ ਇਨਾਮ ਮਿਲਦਾ ਹੈ ਔਰ ਕਈ ਵਾਰ ਤਾਂ ਇੱਦਾਂ ਹੀ ਹੁੰਦਾ ਹੈ ਜਿਵੇਂ ਕੋਈ ਬਹੁਤ ਵਧੀਆ ਖੇਡਿਆ ਉਸਨੂੰ ਕਈ ਉੱਚੇ ਪੱਧਰ 'ਤੇ ਖੇਡਣ ਦਾ ਵੀ ਮੌਕਾ ਮਿਲ ਜਾਂਦਾ ਹੈ ਇਹ ਸਭ ਸਾਰਾ ਪ੍ਰਸਾਰਨ ਲਾਈਵ ਚੱਲਦਾ ਹੈ ਇਸ ਵਿੱਚ ਦੂਰੋਂ ਦੂਰੋਂ ਲੋਕ ਆਉਂਦੇ ਹਨ ਇਸਨੂੰ ਵੇਖਣ ਲਈ ਜਿਹੜਾ ਆਸੇ ਪਾਸੇ ਦੇ ਪਿੰਡਾਂ ਦੇ ਲੋਕ ਵੀ ਸਾਰੇ ਇਕੱਠੇ ਹੁੰਦੇ ਹਨ ਇਹ ਟੂਰਨਾਮੈਂਟ ਦੇਖਣ ਲਈ ਇਸ ਦਿਨ ਤਾਂ ਬੱਚਿਆਂ ਦਾ ਉਤਸਾਹ ਵੀ ਦੇਖਣ ਯੋਗ ਹੁੰਦਾ ਹੈ ਇਹ ਲੋਕ ਪ੍ਰਬੰਧ ਇਸ ਤਰ੍ਹਾਂ ਕਰਦੇ ਹਨ ਜਿਵੇਂ ਕਿ ਸਾਰੇ ਲੋਕ ਜੋ ਕਿ ਬੱਚ ਬੰਦਿਆਂ ਨੂੰ ਮੋਟੀਵੇਟ ਹੁੰਦਾ ਦੇਖਣਾ ਚਾਹੁੰਦੇ ਹਨ ਉਹਨਾਂ ਲਈ ਆਪਣੇ ਜੇਬ ਜੇਬ ਖਰਚੀ 'ਚੋਂ ਥੋੜ੍ਹਾ ਥੋੜ੍ਹਾ ਕੱਢ ਕੇ ਉਹਨਾਂ ਵਾਸਤੇ ਟੂਰਨਾਮੈਂਟ ਔਰਗਨਾਈਜ਼ ਕਰਵਾਉਂਦੇ ਹਨ ਜੋ ਕਿ ਬੱਚਿਆਂ ਵਾਸਤੇ ਬਹੁਤ ਹੀ ਲਾਭਦਾਇਕ ਹੁੰਦਾ ਹੈ ਉਹ ਆਪਣਾ ਉਤਸਾਹ ਵੇਖਦੇ ਹਨ ਕਿ ਬੱਚੇ ਕਿੱਦਾਂ ਉਹਨਾਂ ਨੂੰ ਮੋਟੀਵੇਟ ਮੋਟੀਵੇਟ ਹੁੰਦੇ ਦੇਖਦੇ ਹਨ ਨਾਲੇ ਉਹ ਬੱਚਿਆਂ ਨੂੰ ਉੱਚੇ ਪੱਧਰ 'ਤੇ ਜਾ ਦੇਖਣਾ ਜਾਣਾ ਚਾਹੁੰਦੇ ਹਨ ਮੈਂ ਉਹਨਾਂ ਟੀਮ ਸੰਗਠਨ ਦਾ ਬਹੁਤ ਹੀ ਧੰਨਵਾਦੀ ਹਾਂ ਜੋ ਕਿ ਇਹੋ ਜਿਹੇ ਕੰਮ ਕਰਦੇ ਹਨ ਨ ਨਾਲੇ ਬੱਚਿਆਂ ਦਾ ਉਤਸਾਹ ਵਧਾਉਂਦੇ ਹਨ